ਪੰਜਾਬੀ ਭਾਸ਼ਾ ਵਿੱਚ ਬਹੁਤ ਹੀ ਵਿਲੱਖਣ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਇਸ ਵਿੱਚ ਹਰੇਕ ਧੁਨੀ ਵਿੱਚ ਵੱਖਰੇ ਅੱਖਰ ਦੀ ਵਰਤੋਂ ਕੀਤੀ ਜ ਗਈ ਹੈ ਜਿਵੇਂ ਕਿ ਨੱਨੇ ਅਤੇ ਨਾਣੇ ਇੰਗਲਿਸ਼ ਵਿੱਚ ਐਨ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪੰਜਾਬੀ ਧੁਨੀ ਵਿੱਚ ਨੱਨੇ ਅਤੇ ਨਾਣੇ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਪਸ਼ਟ ਕਰ ਦਿੰਦੀ ਹੈ ਕਿ ਇੰਗਲਿਸ਼ ਅਤੇ ਪੰਜਾਬੀ ਵਿੱਚ ਬਹੁਤ ਅੰਤਰ ਹੈ ਪੰਜਾਬੀ ਭਾਸ਼ਾ ਦੀ ਇੱਕ ਵਿਲੱਖਣਤਾ ਵਿਲੱਖਣਤਾ ਇਹ ਹੈ ਕਿ ਇਹ ਸਾਰਿਆਂ ਨਾਲੋਂ ਵੱਖਰੀ ਅਤੇ ਸੌਖੀ ਹੈ ਭਾਵ ਆਸਾਨ ਹੈ ਇਸ ਵਿੱਚ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਦਾ ਉਚਾਰਨ ਬਹੁਤ ਸੌਖਾ ਹੈ ਕਿਉਂਕਿ ਇਸ ਵਿੱਚ ਅੱਖਰ ਅੱਖਰ ਜਾਂ ਦੁੱਤ ਦਾ ਬਹੁਤ ਘੱਟ ਹੈ ਬਹੁਤ ਆਸਾਨੀ ਨਾਲ ਉਚਾਰਨ ਕੀਤਾ ਜਾ ਸਕਦਾ ਹੈ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਵੇਂ ਭੋਲਾ ਅਤੇ ਭੋਲ਼ਾ ਪਰ ਦੋਵਾਂ ਵਿੱਚ ਬਹੁਤ ਫਰਕ ਹੈ ਇਸ ਤਰ੍ਹਾਂ ਹੀ ਅੰਗਰੇਜ਼ੀ ਨਾਲੋਂ ਪੰਜਾਬੀ ਅਸਾਨ ਬੋਲੀ ਜਾਂਦੀ ਹੈ ਪਰ ਬਹੁਤ ਸਾਰੀਆਂ ਭਾਸ਼ਾ ਵਿੱਚ ਵੱਖਰਾ ਬੋਲਿਆ ਜਾਂਦਾ ਹੈ ਜਿਵੇਂ ਕਿ ਭੋਲਾ ਭੋਲਾ ਜਾਂ ਭੋਲ ਭੋਲੇ ਵਿੱਚ ਫਰਕ ਕਰਨਾ ਹੋਵੇ ਤਾਂ ਲੱਲੇ ਪੈਰ ਬਿੰਦੀ ਪੈਂਦੀ ਹੈ ਪਰ ਸ਼ਬਦਾਂ ਨਾਲ ਵੀ ਇਹ ਅਲੱਗ ਭਾਸ਼ਾ ਬਣ ਜਾਂਦੀ ਹੈ ਜਿਹੜੀ ਕਿ ਪੰਜਾਬੀ ਵਿੱਚ ਪੈਰ 'ਚ ਬਿੰਦੀ ਵਾਲੇ ਸ਼ਬਦ ਨੇ ਉਹਨਾਂ ਦੀ ਧੁਨੀ ਭਾਵ ਭਾਸ਼ਾ ਅਲੱਗ ਹੁੰਦੀ ਹੈ ਜਿਹੜੀ ਕਿ ਹਰੇਕ ਤਰ੍ਹਾਂ ਦੇ ਸ਼ਬਦ ਨੂੰ ਆਸਾਨੀ ਨਾਲ ਬੋਲ ਸਕਦੀ ਹੈ